ਹੈਲੋ ਸੇਠੀ ਕੈਬ ਸਟੋਰ ਜੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਰਾਮ ਲਾਲ ਬੋਲ ਰਿਹਾ ਜੀ ਹੀਰਾ ਨਗਰ ਤੋਂ ਜੀ ਸਰ ਬਾਈ ਨੰਬਰ ਦੇ ਨੇੜੇ ਸਰ ਕੈਬ ਬੁੱਕ ਕਰਾਉਣੀ ਸੀ ਚੰਡੀਗੜ੍ਹ ਏਅਰਪੋਰਟ ਵਾਸਤੇ ਸਰ ਹਾਂਜੀ ਰਾਤ ਨੂੰ ਸਰ ਸਰ ਤਿੰਨ ਵਜੇ ਦੀ ਫਲਾਈਟ ਹੈ ਦੋ ਘੰਟੇ ਮੈਂ ਪਹਿਲਾਂ ਪਹੁੰਚਣਾ ਹੈ ਸਰ ਜੇ ਆਪਾਂ ਗਿਆਰਾਂ ਵਜੇ ਉਰੇ ਤੋਂ ਚੱਲੀਏ ਹਾਂਜੀ ਸਰ ਪੇਮੈਂਟ ਤੁਹਾਡੀ ਮੈਂ ਗੂਗਲ ਪੇਅ ਕਰ ਦਿੰਦਾ ਸਰ ਹਾਫ਼ ਪੇਮੈਂਟ ਗੂਗਲ ਪੇਅ ਕਰ ਦਿੰਦਾ ਪਹੁੰਚਣ ਤੋਂ ਬਾਅਦ ਹਾਫ਼ ਕਰ ਦਿਆਂਗਾ ਸਰ ਜੀ ਸਰ ਬਹੁਤ ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਸਰ